ਜੋ ਵੀ ਇਕਰਾਰਨਾਮਾ ਅਸੀਂ ਬਣਾਉਣਾ ਹੈ ਉਸ ਲਈ ਸਭ ਤੋਂ ਪਹਿਲਾਂ ਤਾਂ ਦੋ ਧਿਰਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੈ ਕਿ ਉਹ ਕਿਸ ਚੀਜ਼ ਦੇ ਲਈ ਇਕਰਾਰਨਾਮਾ ਕਰ ਰਹੇ ਹਨ ਉਸ ਤੋਂ ਬਾਅਦ ਜੋ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਹੋਈ ਫ਼ੀਸ ਹੈ ਉਸ ਉੱਤੇ ਇਕਰਾਰਨਾਮੇ ਨੂੰ ਲਿਖ ਕੇ ਅਤੇ ਦੋਨੇ ਧਿਰਾਂ ਦੇ ਉਸ ਇਕਰਾਰਨਾਮੇ ਉੱਤੇ ਸਭ ਤੋਂ ਪਹਿਲਾਂ ਦਸਤਖ਼ਤ ਹੁੰਦੇ ਹਨ ਅਤੇ ਜੋ ਇਕਰਾਰਨਾਮਾ ਲਿਖਦਾ ਹੈ ਉਸਦੀ ਵੀ ਮੋਹਰ ਲੱਗਦੀ ਹੈ ਅਤੇ ਸਭ ਤੋਂ ਜੋ ਜ਼ਰੂਰੀ ਗੱਲ ਹੈ ਇਕਰਾਰਨਾਮੇ ਵਾਸਤੇ ਦੋ ਗਵਾਹਾਂ ਦਾ ਹੋਣਾ ਜ਼ਰੂਰੀ ਹੈ ਦੋ ਗਵਾਹਾਂ ਦੇ ਜੋ ਦਸਤਖ਼ਤ ਹਨ ਉਹ ਵੀ ਇਕਰਾਰਨਾਮੇ 'ਤੇ ਹੁੰਦੇ ਹਨ